ਅੱਜ ਕੱਲ ਦੇ ਆਧੁਨਿਕ ਯੁੱਗ ਦੇ ਵਿੱਚ ਬਹੁਤ ਹੀ ਤਰ੍ਹਾਂ ਦੇ ਬਣੇ ਬਣਾਏ ਤੇ ਮਸ਼ੀਨੀ ਕੱਪੜੇ ਬਾਜ਼ਾਰਾਂ ਵਿੱਚ ਆਉਂਦੇ ਹਨ ਪਰ ਮੇਰੀ ਇਹ ਸੋਚ ਹੈ ਕਿ ਮਸ਼ੀਨੀ ਕੱਪੜਿਆਂ ਦੇ ਨਾਲੋਂ ਜੋ ਹੱਥ ਦੇ ਬਣੇ ਤੇ ਹੱਥ ਦੇ ਬੁਣੇ ਕੱਪੜੇ ਹਨ ਉਹਨਾਂ ਦੀ ਇੱਕ ਵੱਖਰੀ ਹੀ ਸ਼ਾਨ ਆਣ ਤੇ ਬਾਣ ਹੈ ਹੱਥ ਦੇ ਬੁਣੇ ਹੋਏ ਕੱਪੜਿਆਂ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਹੀ ਸੱਭਿਆਚਾਰ ਦਰਸ਼ਨ ਦਰਸ਼ਾ ਦਰਸ਼ਾਇਆ ਜਾਂਦਾ ਹੈ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਡਾ ਪੰਜਾਬੀ ਸੱਭਿਆਚਾਰ ਸ਼ੁਰੂ ਤੋਂ ਹੀ ਬਹੁਤ ਹੀ ਨਿਘੜਵਾ ਰਿਹਾ ਹੈ ਸਾਡੇ ਅੱਜ ਕੱਲ ਦੇ ਜਿਹੜੇ ਯੁਵਾ ਹਨ ਉਹ ਮਸ਼ੀਨਾਂ ਰਾਹੀਂ ਬਣੇ ਬਣਾਏ ਰੈਡੀਮੇਡ ਕੱਪੜੇ ਪਾਉਣ ਦੇ ਵਿੱਚ ਬਹੁਤ ਹੀ ਖੁਸ਼ ਹੁੰਦੇ ਹਨ ਪਰ ਜੋ ਮਜਾ ਹੱਥ ਦੇ ਬੁਣੇ ਤੇ ਹੱਥ ਦੇ ਬਣਾਏ ਕੱਪੜਿਆਂ ਦਾ ਹੈ ਉਹ ਕਿਸੇ ਚੀਜ਼ ਦੇ ਵਿੱਚ ਨਹੀਂ ਹ ਜਿਵੇਂ ਕਿ ਹੁਣ ਤੁਸੀਂ ਦੇਖਦੇ ਹੋ ਕਿ ਅੱਜ ਕੱਲ ਵਿਆਹ ਸ਼ਾਦੀ ਤੇ ਫੰਕਸ਼ਨਾਂ ਦੇ ਵਿੱਚੋਂ ਵੀ ਹੱਥ ਦੀ ਬਣੀਆਂ ਫੁਲਕਾਰੀਆਂ ਬਹੁਤ ਹੀ ਜਿਆਦਾ ਰਵਾਜ ਦੇ ਵਿੱਚ ਹਨ ਲੋਕੀ ਇਸ ਨੂੰ ਆਪਣਾ ਸੱਭਿਆਚਾਰ ਦਰਸ਼ਾਣਾ ਜਿਆਦਾ ਪਸੰਦ ਕਰਦੇ ਹਨ ਤੇ ਜਿਹੜੇ ਹੱਥ ਦੇ ਬਣੇ ਹੋਏ ਕੱਪੜੇ ਹੁੰਦੇ ਹਨ ਜਿਵੇਂ ਕਿ ਅਸੀਂ ਸਰਦੀਆਂ ਦੇ ਵਿੱਚ ਹੱਥ ਦੇ ਬੁਣੇ ਸਵੈਟਰ ਬਣਾਉਦੇ ਹਾਂ ਉਹਦਾ ਘਰ ਦੇ ਵਿੱਚ ਆਪਣਾ ਹੀ ਅਲੱਗ ਹੀ ਪਾਣ ਦਾ ਮਜ਼ਾ ਹੈ ਅਸੀਂ ਵੱਖ ਵੱਖ ਤਰਾਂ ਦੇ ਡਿਜਾਇਨ ਪਾ ਪਾ ਕੇ ਕਈ ਤਰਾਂ ਦੇ ਰੰਗਾਂ ਦੀ ਸਿਲਾਈ ਕਰਕੇ ਤੇ ਉਹ ਕੱਪੜਿਆਂ ਨੂੰ ਬਾਹਰ ਵੀ ਪਾ ਕੇ ਕਿਤੇ ਜਾਈਏ ਤਾਂ ਦੂਰੋਂ ਅਲੱਗ ਹੀ ਪਤਾ ਲੱਗਦੇ ਹਨ ਮਸ਼ੀਨੀ ਕੱਪੜਿਆਂ ਦੇ ਵਿੱਚ ਸੋਖ ਤਾਂ ਖਰੀਦਣ ਚ ਬਹੁਤ ਹੈ ਪਰ ਜੋ ਮਜ਼ਾ ਹੱਥ ਦੀ ਮਿਹਨਤ ਕਰਕੇ ਬਣਾਏ ਹੋਏ ਕੱਪੜਿਆਂ ਨੂੰ ਪਾਣ ਦੇ ਵਿੱਚ ਹੈ ਉਹ ਸਾਨੂੰ ਮਸ਼ੀਨੀ ਕੱਪੜਿਆਂ ਦੇ ਵਿੱਚ ਨਹੀਂ ਮਿਲਦਾ ਧੰਨਵਾਦ